ਯੂਟਿਊਬ ਦੇ ਪੰਜਾਬੀ ਤੜਕਾ ਨਾਂ ਦਾ ਚੈਨਲ ਹੈ ਜਿਸ ਉੱਤੇ ਅਲੱਗ ਅਲੱਗ ਵਿਅੰਜਨ ਬਣਾਉਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਮੇਰੇ ਪਸੰਦ ਦਾ ਭੋਜਨ ਡੋਸਾ ਹੈ ਜੋ ਕਿ ਸਾਊਥ ਇੰਡੀਅਨ ਦੀ ਪ੍ਰਸਿੱਧ ਵਿਅੰਜਨ ਹੈ ਜੋ ਕਿ ਮੈਂ ਇਸ ਚੈਨਲ ਦੇ ਦੁਆਰਾ ਪਹਿਲੀ ਵਾਰ ਬਣਾਉਣਾ ਸਿੱਖਿਆ ਹੈ ਉਹਨਾਂ ਦੇ ਦੱਸੇ ਤਰੀਕੇ ਅਨੁਸਾਰ ਮੈਂ ਡੋਸਾ ਬਣਾਇਆ ਅਤੇ ਸਭ ਨੂੰ ਬਹੁਤ ਪਸੰਦ ਆਏ ਆਇਆ ਟੀ ਵੀ 'ਤੇ ਮੇਰਾ ਪਸੰਦੀਦਾ ਪ੍ਰੋਗਰਾਮ ਮਾਸਟਰ ਸ਼ੈੱਫ ਹੈ ਜਿਸ ਉੱਤੇ ਅਲੱਗ ਅਲੱਗ ਵਿਅੰਜਨ ਬਣਾਉਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਚੈਨਲ ਤੋਂ ਵੀ ਮੈਂ ਬਹੁਤ ਕੁਛ ਸਿੱਖਿਆ ਹੈ ਅਤੇ ਅਲੱਗ ਅਲੱਗ ਮਸਾਲਿਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਬਹੁਤ ਤਰ੍ਹਾਂ ਦੇ ਵਿਅੰਜਨ ਬਣਾਉਣੇ ਸਿਖਾਉਂਦੇ ਹਨ ਕਿਉਂ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ ਅਤੇ ਇਸ ਕਰਕੇ ਮੈਨੂੰ ਮੈਂ ਇਹਨਾਂ ਚੈਨਲਾਂ ਨੂੰ ਬਹੁਤ ਧਿਆਨ ਨਾਲ਼ ਵੇਖਦੀ ਹਾਂ ਅਤੇ ਜੋ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ ਮੈਂ ਘਰ ਜ਼ਰੂਰ ਬਣਾਉਂਦੀ ਹਾਂ ਅਤੇ ਆਪਣੇ ਪਰਿਵਾਰ ਨੂੰ ਖਿਲ਼ਾਉਂਦੀ ਹਾਂ